ਹਾਂ ਇਲੈਕਟਰੋਨਿਕ ਸੰਸਕਰਨਾਂ ਨਾਲੋਂ ਜ਼ਿਆਦਾ ਮੈਂ ਭੌਤਿਕ ਕਿਤਾਬਾਂ ਨੂੰ ਪੜ੍ਹਨਾ ਪਸੰਦ ਕਰਦਾ ਹਾਂ ਅੱਜ ਕੱਲ੍ਹ ਦੀ ਜਨਰੇਸ਼ਨ ਆ ਉਹ ਜਿਹੜੀ ਟੈਕਨੋਲੋਜੀ ਵੱਲ ਜ਼ਿਆਦਾ ਵੱਧ ਰਹੀ ਹੈ ਲੋਕ ਔਨਲਾਈਨ ਬੁੱਕਸ ਲੈਪਟੋਪਸ ਫੋਨਸ ਮੋਬਾਈਲ ਫੋਨਸ ਦੇ ਉੱਪਰ ਪੜ੍ਹਨਾ ਜ਼ਿਆਦਾ ਪ੍ਰੈਫਰ ਕਰਦੇ ਹਨ ਇਸ ਨਾਲ ਤੁਹਾਨੂੰ ਭਾਰ ਨਹੀਂ ਚੱਕਣਾ ਪੈਂਦਾ ਪਰ ਮੇਰੇ ਅਕੋਰਡਿੰਗ ਜਿਹੜੇ ਤੁਸੀਂ ਇਲੈਕਟਰੋਨਿਕ ਮੀਡੀਆ ਤੋਂ ਥਰੂ ਪੜ੍ਹਦੇ ਹੋ ਉਹਨਾਂ ਨਾਲੋਂ ਜ਼ਿਆਦਾ ਜੇਕਰ ਅਸੀਂ ਭੌਤਿਕ ਕਿਤਾਬਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਹਾਂ ਤਾਂ ਇੱਕ ਤਾਂ ਇਸ ਨਾਲ ਸਾਡੀ ਆਈ ਸਾਈਟ 'ਤੇ ਜ਼ਿਆਦਾ ਅਸਰ ਨਹੀਂ ਪੈਂਦਾ ਅਤੇ ਨਾਲੇ ਜਦੋਂ ਤੁਸੀਂ ਆਪ ਕਿਤਾਬ ਹੱਥ ਵਿੱਚ ਲੈ ਕੇ ਪੜ੍ਹਦੇ ਹੋ ਤਾਂ ਜਿਹੜੇ ਅੱਖਰ ਨੇ ਉਹ ਮੇਰੇ ਅਕੋਰਡਿੰਗ ਫੀਲ ਜ਼ਿਆਦਾ ਹੁੰਦਾ ਜੇਕਰ ਅਸੀਂ ਕਿਤਾਬਾਂ ਨੂੰ ਲੈ ਕੇ ਪੜ੍ਹਦੇ ਹਾਂ ਅਤੇ ਜੇ ਗੱਲ ਕਰਾਂ ਆਡੀਓ ਬੁੱਕਸ ਦੀ ਤਾਂ ਮੈਂ ਅੱਜ ਤੱਕ ਕਦੇ ਆਡੀਓ ਬੁੱਕਸ ਨਹੀਂ ਸੁਣੀਆ ਮੈਂ ਖੁਦ ਆਪ ਪੜ੍ਹਨਾ ਪ੍ਰੈਫਰ ਕਰਦੀ ਹਾਂ ਅਤੇ ਮੈਨੂੰ ਨਹੀਂ ਲੱਗਦਾ ਕਿ ਆਡੀਓ ਬੁੱਕਸ ਨੂੰ ਸੁਣ ਕੇ ਉਨਾ ਜ਼ਿਆਦਾ ਤੁਸੀਂ ਨੋਲੇਜ ਗੇਨ ਕਰ ਸਕਦੇ ਹੋ ਜਿੰਨਾ ਕਿ ਤੁਸੀਂ ਆਪ ਕਿਤਾਬ ਨੂੰ ਹੱਥ ਵਿੱਚ ਫੜ ਕੇ ਪੜ੍ਹ ਕੇ ਕਰਦੇ ਹੋ